ਹੋਰ ਪਾਸੇ ਦੇ ਕਾਫੀ ਕੰਮ ਹਨ ਜੋ ਕਿ ਕਿਸਾਨ ਕਰ ਸਕਦਾ ਹੈ ਜਿਵੇਂ ਕਿ ਉਹ ਆਪਣਾ ਫਾਰਮ ਖੋਲ੍ਹ ਸਕਦਾ ਫਾਰਮ ਵਿੱਲਾ ਖੋਲ੍ਹ ਸਕਦਾ ਹੈ ਤਾਂ ਕਿ ਉਹਦੇ 'ਤੇ ਮੁਰਗੀਆਂ ਦਾ ਕੰਮ ਸ਼ੁਰੂ ਕਰ ਸਕਦਾ ਮੁਰਗੀਆਂ ਦੀ ਸਬਸਿਡੀ ਵੀ ਸਰਕਾਰ ਦਿੰਦੀ ਹੈ ਅਤੇ ਉਹ ਜਾਂ ਆਪਣਾ ਕੋਈ ਸ਼ੋਅਰੂਮ ਖੋਲ੍ਹ ਸਕਦਾ ਹੈਗਾ ਜਿਹਦੇ ਕਿ ਆਪਣਾ ਉਹਦੇ ਵਿੱਚ ਚੀਜ਼ਾਂ ਯੂਜ਼ ਹੁੰਦੀਆਂ ਖੇਤੀਬਾੜੀ ਦੇ ਵਿੱਚ ਜਿਵੇਂ ਕੋਈ ਵੀ ਸਵਾਹ ਪਾਉਣੀ ਹੈ ਖਰਾਕ ਪਾਉਣੀ ਹੈ ਜਾਂ ਕੋਈ ਹੋਰ ਚੀਜ਼ ਜਿਹੜੀ ਕਿ ਖੇਤੀਬਾੜੀ ਦੇ ਨਾਲ ਮਿਲਦੀ ਜੁਲਦੀ ਹੈ ਤਾਂ ਉਹ ਬੰਦਾ ਉਸਨੂੰ ਕਰ ਸਕਦਾ ਹੋਰ ਵੀ ਕਾਰੋਬਾਰ ਕਾਫੀ ਹੈਗੇ ਹੈਗੇ ਕਿ ਕਿਸਾਨ ਜੋ ਕਰ ਸਕਦਾ ਹੈਗਾ ਟਰੈਕਟਰ ਦੇ ਸ਼ੋਅਰੂਮ ਦੇ ਉੱਪਰ ਆਪਣਾ ਕੰਮ ਕਾਰ ਚਲਾ ਸਕਦਾ ਹੈਗਾ ਅਤੇ ਬਾਕੀ ਉਹ ਦਿਹਾੜੀ 'ਤੇ ਵੀ ਕੰਮ ਕਰ ਸਕਦਾ ਜਾਂ ਕਿਸੇ ਤੋਂ ਕਿੱਲਾ ਵਾਹੁਣ ਦਾ ਲੈ ਲਏ ਹੈ ਨਾ ਤਾਂ ਉਹ ਚੀਜ਼ ਉਹ ਯੂਜ਼ ਕਰਕੇ ਆਪਦਾ ਅੱਗੇ ਕੰਮ ਚਲਾ ਸਕਦਾ ਹੈ ਤਾਂ ਕਿ ਕਿਸਾਨ ਦਾ ਇਹ ਜ਼ਰੂਰੀ ਨਹੀਂ ਹੈਗਾ ਕਿ ਕਿਸਾਨ ਕੋਲ ਜ਼ਮੀਨ ਹੋਣੀ ਜ਼ਰੂਰੀ ਹੈ ਤਾਂ ਉਹ ਕਿਸੇ ਦੇ ਖੇਤ ਦੇ ਵਿੱਚ ਜਾ ਕੇ ਵੀ ਆਪਣੀ ਵਾਹੀ ਕਰ ਸਕਦਾ ਅਤੇ ਉੱਥੋਂ ਆਪਣੇ ਪੈਸੇ ਕਮਾ ਸਕਦਾ